ਮੈਨੂੰ ਦੌੜਨ ਲਈ ਅੱਜ ਤੋਂ ਤਿੰਨ ਸਾਲ ਪਹਿਲਾਂ ਭਾਗ ਮਿਲਖਾ ਭਾਗ ਫਿਲਮ ਆਈ ਸੀ ਉਸ ਫਿਲਮ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਮੈਂ ਉਸ ਤੋਂ ਬਾਅਦ ਇਹ ਪੇਸ਼ਾ ਜਾਂ ਸ਼ੌਕ ਆਪਣਾ ਦੌੜ ਲਈ ਲਾ ਲਿਆ ਪਰ ਇਸਨੇ ਮੈਨੂੰ ਪ੍ਰਾਪਤੀਆਂ ਵੀ ਬਹੁਤ ਦਿੱਤੀਆਂ ਜਿਵੇਂ ਕਿ ਮੈਂ ਸਟੇਟ ਲੈਵਲ 'ਤੇ ਪਹਿਲਾਂ ਡਿਸਟਿਕ ਲੈਵਲ 'ਤੇ ਫੇਰ ਸਟੇਟ ਲੈਵਲ 'ਤੇ ਫੇਰ ਨੈਸ਼ਨਲ ਲੇਵਲ 'ਤੇ ਵੀ ਖੇਡਿਆ ਅਤੇ ਇਸਦੇ ਨਾਲ ਮੈਂ ਹਾਕੀ ਵੀ ਬਹੁਤ ਵਧੀਆ ਖੇਡਿਆ ਜਦੋਂ ਮੈਂ ਛੋਟਾ ਪਿੰਡ ਛੋਟਾ ਹੁੰਦਾ ਸੀ ਤਾਂ ਪਿੰਡ ਵਿੱਚ ਫੁੱਟਬਾਲ ਖੇਡਦਾ ਸੀ ਸਕੂਲ ਵਿੱਚ ਕਬੱਡੀ ਖੇਡਦਾ ਸੀ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਇਸਨੇ ਸ ਮ ਮੇਰੀਆਂ ਸਰੀਰਕ ਜੋ ਮੈਨੂੰ ਫੀਲ ਹੁੰਦਾ ਹੈ ਕਿ ਮੈਂ ਪੰਤਾਲੀ ਮਿੰਟ ਲਗਾਤਾਰ ਬਿਨ੍ਹਾਂ ਰੁਕੇ ਦੌੜ ਸਕਦਾ ਹਾਂ